ਹਾਂ ਮੈਂ ਮੁਕਾਬਲੇ ਵਿੱਚ ਆਪਣੀ ਚਿੱਤਰ ਕਲਾ ਦੀ ਕਲਾਕਾਰੀ ਦਿਖਾਈ ਹੈ ਮੈਂ ਜ਼ਿਲ੍ਹੇ ਪੱਧਰ 'ਤੇ ਚਿੱਤਰ ਕਲਾ ਵਿੱਚ ਭਾਗ ਲਿਆ ਉੱਥੇ ਵੱਖ ਵੱਖ ਸਕੂਲਾਂ ਤੋਂ ਬੱਚੇ ਆਏ ਸੀ ਉਸ ਭਾਗ ਵਿੱਚ ਪੰਜ ਰਾਊਂਡ ਸੀ ਪੰਜੇ ਰਾਊਂਡ ਵੱਖਰੇ ਵੱਖਰੇ ਸੀ ਉੱਥੇ ਮਹਾਨ ਸ਼ਖਸੀਅਤਾਂ ਆਈਆਂ ਹੋਈਆਂ ਸੀ ਸਭ ਤੋਂ ਪਹਿਲਾਂ ਚਿੱਤਰ ਕਲਾ ਵਿੱਚ ਮੈਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਉਸ ਚਿੱਤਰ ਦੇ ਵਿੱਚ ਵੱਖ ਵੱਖ ਕਲਰ ਵਰਤੇ ਇਸ ਰਾਊਂਡ ਵਿੱਚ ਛੇ ਬੱਚੇ ਰੱਖੇ ਗਏ ਦੂਜੇ ਰਾਊਂਡ ਵਿੱਚ ਵੀ ਮਹਾਤਮਾ ਗਾਂਧੀ ਦੀ ਤਸਵੀਰ ਬਣਾਈ ਇਸ ਰਾਊਂਡ ਵਿੱਚ ਵੀ ਮੈਂ ਦੂਸਰੇ ਸਥਾਨ 'ਤੇ ਰਹੀ ਹਾਂ ਚਿੱਤਰ ਬਣਾਉਣ ਲਈ ਵੱਖ ਵੱਖ ਕਲਰ ਥਰਮਲ ਦਾ ਗੱਤਾ ਚਿੱਤਰ ਚਾਟ 'ਤੇ ਬਣਾਇਆ ਫਿਰ ਉਸਨੂੰ ਥਰਮਲ 'ਤੇ ਚਿਪਕਾਇਆ ਅਤੇ ਟੇਪ ਕੀਤੀ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਸਾਰੇ ਰਾਊਂਡ ਪਾਰ ਕਰ ਲਏ ਅੰਤ ਮੈਂ ਫਾਈਨਲ ਵਿੱਚ ਪਹੁੰਚ ਗਈ ਫਾਈਨਲ ਰਾਊਂਡ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾਈ ਇਹ ਤਸਵੀਰ ਇੰਨੀ ਸੋਹਣੀ ਬਣੀ ਕਿ ਮੈਂ ਪਹਿਲੇ ਨੰਬਰ 'ਤੇ ਆ ਗਈ ਅਤੇ ਉੱਥੇ ਆਈਆਂ ਸ਼ ਮਹਾਨ ਸ਼ਖਸੀਅਤਾਂ ਅਤੇ ਪ੍ਰਿੰਸੀਪਲ ਨੇ ਬਹੁਤ ਸਨਮਾਨ ਵਧਾਇਆ